ਮੈਨੂੰ ਬਚਪਨ ਤੋਂ ਹੀ ਡਾਂਸ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਦੇਖਣ ਦਾ ਵੀ ਬਹੁਤ ਸ਼ੌਂਕ ਹੈ ਮੈਂ ਸਕੂਲ ਕਾਲਜ ਸਮੇਂ ਜਦੋਂ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਮੈਂ ਇਹਨਾਂ ਵਿੱਚ ਹਿੱਸਾ ਅਕਸਰ ਲੈਂਦੀ ਰਹਿੰਦੀ ਸੀ ਮੈਨੂੰ ਨੱਚਣ ਗਾਉਣ ਦਾ ਹਮੇਸ਼ਾਂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਹੈ ਜਦੋਂ ਵੀ ਕਿਸੇ ਸਟੇਟ ਲੈਵਲ ਜਾਂ ਨੈਸ਼ਨਲ ਲੈਵਲ 'ਤੇ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਵਿੱਚ ਵੀ ਮੈਂ ਅਕਸਰ ਭਾਗ ਲਿਆ ਹੈ ਅਤੇ ਜਿੱਤ ਪ੍ਰਾਪਤ ਕੀਤੀ ਹੈ ਮੈਂ ਇਸ ਸੰਬੰਧੀ ਬਹੁਤ ਵਧੀਆ ਆਉਣ ਵਾਲੇ ਸਮੇਂ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦੀ ਹਾਂ ਮੈਨੂੰ ਡਾਂਸ ਦੇ ਨਾਮ 'ਤੇ ਹਰ ਕੋਈ ਜਾਣੇ ਇਸ ਤਰ੍ਹਾਂ ਮੈਂ ਆਪਣਾ ਸ਼ਖਸ਼ੀਅਤ ਕ੍ਰੀਏਟ ਕਰਨਾ ਚਾਹੁੰਦੀ ਹਾਂ ਮੈਨੂੰ ਗਿੱਧਾ ਭੰਗੜਾ ਬਹੁਤ ਪਸੰਦ ਹੈ ਮੈਂ ਗਿੱਧੇ ਵਿੱਚ ਅਕਸਰ ਭਾਗ ਲੈਂਦੀ ਰਹਿੰਦੀ ਹਾਂ ਅਤੇ ਮੈਂ ਇਸ ਨੂੰ ਨੈਸ਼ਨਲ ਲੈਵਲ 'ਤੇ ਖੇਡਣਾ ਚਾਹੁੰਦੀ ਹਾਂ